ਸਵੇਰ ਦੀ ਸੈਰ ਸਵੇਰ ਦੀ ਸੈਰ ਜਿਹੜੀ ਹੈਗੀ ਹੈ ਉਹ ਪੈਦਲ ਵੀ ਕੀਤੀ ਜਾ ਸਕਦੀ ਹੈ ਅਤੇ ਸਾਈਕਲ ਰਾਹੀਂ ਸਾਈਕਲ ਰਾਹੀਂ ਵੀ ਆਪਣੇ ਸਰੀਰ ਦਾ ਜ਼ੋਰ ਲੱਗ ਰਿਹਾ ਹੈ ਤਾਂ ਕਰਕੇ ਮੈਂ ਚਾਹੁੰਦੀ ਹਾਂ ਜਿਵੇਂ ਸੁਬਹੇ ਸੁਬਹਾ ਉੱਠਣਾ ਬਹੁਤ ਔਖਾ ਲੱਗਦਾ ਪਰ ਜੇ ਕਦੇ ਉੱਠ ਜਾਵਾਂ ਤਾਂ ਸਾਈਕਲ ਲੈ ਕੇ ਇੱਕ ਰੂਟ ਕੱਢ ਆਵਾਂ ਠੰਢੀ ਠੰਢੀ ਹਵਾ ਦੇ ਵਿੱਚ ਅਤੇ ਫਿਰ ਜਿਹੜਾ ਕਿ ਮੈਂ ਸਾਈਕਲ ਨੂੰ ਵੀ ਵਧੀਆ ਇਸਤੇਮਾਲ ਕਰ ਸਕਦੀ ਹਾਂ ਅਤੇ ਆਪਦਾ ਜਿਹੜੀ ਰੁਚੀ ਹੈਗੀ ਆ ਉਸ ਨੂੰ ਵੀ ਪੂਰਾ ਕਰ ਸਕਦੀ ਹਾਂ ਮੈਂ ਜਾਣਾ ਚਾਹੁੰਦੀ ਹਾਂ ਕਿਤੇ ਲੰਬੀ ਸੈਰ ਦੇ ਉੱਤੇ ਜਿੱਥੇ ਰਾਹ ਬਹੁਤ ਹੀ ਸੋਹਣਾ ਹੋਵੇ ਅਤੇ ਖੁੱਲ੍ਹੀ ਸਾਈਕਲ ਦੇ ਉੱਤੇ ਬਹੁਤ ਹੀ ਵਧੀਆ ਲੱਗੇ ਜਿੱਥੇ ਆਪਾਂ ਨੂੰ ਗੱਡੀ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਸਕਦਾ ਜਾਂ ਉਸਦਾ ਆਨੰਦ ਨਹੀਂ ਲਿਆ ਜਾ ਸਕਦਾ ਉਹ ਇੱਕ ਸਾਈਕਲ 'ਤੇ ਲਿਆ ਜਾ ਸਕਦਾ ਹੈ ਸਾਈਕਲ ਇੱਕ ਬਹੁਤ ਹੀ ਸੋਹਣਾ ਸਫਰ ਹੈ ਸਾਈਕਲ ਦੇ ਉੱਤੇ ਅਤੇ ਮੈਂ ਚਾਹੁੰਦੀ ਹਾਂ ਨਾਲ ਮੇਰਾ ਘਰ ਵਾਲਾ ਹੋਵੇ ਅਤੇ ਨਾਲ ਇੱਕ ਸਾਈਕਲ ਮੇਰੇ ਕੋਲ ਹੋਵੇ ਦੋਨੋਂ ਜਣੇ ਅਸੀਂ ਜਾਈਏ ਲੰਬੇ ਰੂਟ 'ਤੇ